ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਬੜਾ ਯਾਰ ਦੁੱਖ ਹੋਇਆ ਜਾਣ ਕੇ ਹਾਂਜੀ ਆਹੋ ਮੈਨੂੰ ਪਤਾ ਲੱਗਿਆ ਸੀਗਾ ਵੀ ਯਾਰ ਤੁਹਾਡੇ ਫਾਦਰ ਐਂਡ ਮਦਰ ਜੀ ਉਹਨਾਂ ਦੀ ਐਕਸੀਡੈਂਟ ਵਿੱਚ ਡੈਥ ਹੋ ਗਈ ਹੈਂ ਬੜੀ ਯਾਰ ਮਾੜੀ ਚਲੋ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਠੀਕ ਹੈ ਜੀ ਭਾਅ ਜੀ ਹੁਣ ਮੈਨੂੰ ਇਹ ਦੱਸੋ ਬਈ ਆਪਾਂ ਕਿੱਦਾਂ ਕਰਨੀ ਤੁਸੀਂ ਕਿਆ ਚਾਹੁੰਦੇ ਬੰਦਾ ਹੈਗਾ ਮੇਰਾ ਮੈਂ ਫੋਨ ਕਰ ਦਿੰਦਾ ਤੁਸੀਂ ਠੀਕ ਹੈ ਜੀ ਕੋਈ ਤੁਹਾਨੂੰ ਘੁੰਮਣ ਘੁਮਾਉਣ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਆਪਣਾ ਬੈਠ ਕੇ ਆਪਣਾ ਚਿੰਤਨ ਕਰੋ ਮਹਾਰਾਜ ਦਾ ਨਾਮ ਧਿਆਓ ਆਪਣਾ ਪਰਮਾਤਮਾ ਨੂੰ ਯਾਦ ਕਰੋ ਕੰਮ ਬਾਕੀ ਮੈਂ ਸਾਰਾ ਕਰਾ ਦੇਣਾ ਮੈਂ ਤੁਹਾਨੂੰ ਵਟਸਐਪ 'ਤੇ ਮੈਸੇਜ ਕਰ ਦੂੰਗਾ ਜਿਹੜੇ ਡਾਕੂਮੈਂਟ ਸੀ ਮੈਨੂੰ ਲੋੜ ਹੋਈ ਤੁਸੀਂ ਮੈਨੂੰ ਪਜਾ ਦਿਓ ਬਾਕੀ ਕੰਮ ਤੁਹਾਡਾ ਮੈਂ ਸਾਰਾ ਉੱਧਰੋਂ ਆਪਾਂ ਕਰਵਾ ਦਵਾਂਗੇ ਮੇਰਾ ਡੀ ਸੀ ਦਫ਼ਤਰ ਦੇ ਵਿੱਚ ਐਸ ਡੀ ਐਮ ਦਫ਼ਤਰ ਦੇ ਵਿੱਚ ਵੀ ਸਾਰੇ ਜਿਹੜੇ ਬੰਦੇ ਆਪਣੇ ਹੈਗੇ ਹੈ ਯਾਰ ਵੈਲੀ ਹੈਗੇ ਉਹ ਜ਼ਰੂਰ ਆਪਣੀ ਇਹ ਜਿਹੀ ਸਥਿਤੀ ਵਿੱਚ ਮੈਨੂੰ ਵਿਸ਼ਵਾਸ ਹੈ ਵੀ ਆਪਣੀ ਮਦਦ ਹਿੱਕ ਠੋਕ ਕੇ ਕਰੁੰਗੇ ਬਾਈ ਜੀ ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਸ ਮੈਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਜਿਹੜਾ ਇਹ ਭਾਣਾ ਮੰਨਣ ਦਾ ਜਿਹੜਾ ਬਲ ਬਖਸ਼ਾ ਬਾਈ ਜੀ ਤੁਸੀਂ ਆਪਣੀ ਹੁਣ ਅੱਗੇ ਜ਼ਿੰਦਗੀ ਦੇਖੋ ਪਰਮਾਤਮਾ ਤੁਹਾਡੇ ਮਾਤਾ ਪਿਤਾ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਵੈ ਸਤਿ ਸ਼੍ਰੀ ਅਕਾਲ ਬਾਈ ਜੀ ਬਸ ਮੈਨੂੰ ਦੱਸ ਦਿਓ ਵਟਸਐਪ 'ਤੇ ਮੈਂ ਤੁਹਾਨੂੰ ਮੈਸੇਜ ਕਰ ਦਿੰਦਾ ਜਿਹੜੇ ਜਿਹੜੇ ਸਰਟੀਫਿਕੇਟ ਪ੍ਰਾਪਤ ਕਰਨ ਲਈ ਸਾਨੂੰ ਜਿਹੜੇ ਮੌਤ ਅਤੇ ਆਪਾਂ ਲੈਣੇ ਆ ਡੈਥ ਦਾ ਉਹਨਾਂ ਵਾਸਤੇ ਜੋ ਵੀ ਸਾਡੀ ਜਿਹੜੀ ਲੀਗਰ ਕਾਰਵਾਈ ਹੈ ਮੈਂ ਐਡਵੋਕੇਟ ਨਾਲ ਗੱਲ ਕਰਕੇ ਉਹ ਤੁਹਾਨੂੰ ਜਿਹੜਾ ਫੋਨ ਕਰਦਾ ਬੈਕ ਕਾਲ ਕਰਦਾ ਜਾਂ ਤੁਹਾਨੂੰ ਮੈਸੇਜ ਕਰਦਾ ਧੰਨਵਾਦ ਜੀ